ਹਾਂ ਮੇਰੇ ਕੋਲ ਮਾਰਕਸ ਔਰੇਲਿਅਸ ਦੀ ਮੈਡੀਟੇਸ਼ਨ ਕਿਤਾਬ ਹੈ ਇਹ ਕਿਤਾਬ ਬਹੁਤ ਹੀ ਮਜ਼ੇਦਾਰ ਹੈ ਅਤੇ ਬਹੁਤ ਹੀ ਰੌਚਕ ਬਹੁਤ ਹੀ ਵਧੀਆ ਕਿਤਾਬ ਹੈ ਇਹ ਉਸ ਨੇ ਕਿਤਾਬ ਨੂੰ ਮੈਡੀਟੇਸ਼ਨ ਦੇ ਬਾਰੇ ਵਿੱਚ ਲਿਖਿਆ ਹੈ ਕਿ ਅਸੀਂ ਆਪਣੇ ਆਤਮਾ ਨੂੰ ਆਪਣੇ ਮਨ ਦੇ ਭਾਵਾਂ ਨੂੰ ਆਪਣੇ ਵੱਸ ਵਿੱਚ ਆਪਣੇ ਕੰਟਰੋਲ ਵਿੱਚ ਕਿਵੇਂ ਕੀਤਾ ਜਾਂਦਾ ਹੈ ਇਹ ਕਿਤਾਬ ਬਹੁਤ ਹੀ ਵਧੀਆ ਹੈ ਉਸਨੇ ਮਾਰਕਸ ਨੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਮੈਡੀਟੇਸ਼ਨ 'ਤੇ ਲਿਖੀਆਂ ਹਨ ਇਸ ਇਹ ਕਿਤਾਬ ਉਸ ਨੇ ਆਪਣੇ ਖ਼ਾਸ ਉਸਨੇ ਆਪਣੇ ਵਾਸਤੇ ਲਿਖੀ ਹੈ ਆਪਣੇ ਭਾਵਾਂ ਨੂੰ ਯੂਨੀਵਰਸ ਆਪਣੀ ਯੂਨੀਵਰਸ ਨੂੰ ਜਾਨਣ ਵਾਸਤੇ ਉਸਦੀ ਕੋਸ਼ਿਸ਼ ਕਰਨ ਵਾਸਤੇ ਆਪਣੇ ਬਿਹੇਵੀਅਰ ਅਤੇ ਆਪਣੇ ਆਪ 'ਤੇ ਕਿਵੇਂ ਕੰਟਰੋਲ ਕੀਤਾ ਜਾਂਦਾ ਹੈ ਆਪਣੇ ਭਾਵਾਂ ਨੂੰ ਕਿਵੇਂ ਆਪਣੇ ਵੱਸ ਵਿੱਚ ਕੀਤਾ ਜਾਂਦਾ ਹੈ ਮੈਡੀਟੇਸ਼ਨ ਕਰਕੇ ਆਪਣੀ ਮਨ ਨੂੰ ਕਿਵੇਂ ਸ਼ਾਂਤ ਕੀਤਾ ਜਾਂਦਾ ਹੈ ਇਹ ਕਿਤਾਬ ਬਹੁਤ ਹੀ ਵਧੀਆ ਮੈਂ ਬਹੁਤ ਜ਼ਿਆਦਾ ਲੋਕਾਂ ਕੋਲ ਇਸ ਬਾਰੇ ਸੁਣਿਆ ਸੀ ਫਿਰ ਇਹ ਕਿਤਾਬ ਮੈਨੂੰ ਪਤਾ ਲੱਗੀ ਇਹ ਮੋਹਾਲੀ ਵਿੱਚ ਕਲਾਸਿਕ ਕਿਤਾਬਾਂ ਦਾ ਸਟੋਰ ਹੈ ਉੱਥੋਂ ਜਾ ਕੇ ਮੈਨੂੰ ਇਹ ਕਿਤਾਬ ਮਿਲੀ ਅਤੇ ਇਸ ਨੂੰ ਮੈਂ ਬਹੁਤ ਹੀ ਕੀ ਮੁਸ਼ਕਿਲ ਜਾ ਕੇ ਉੱਥੇ ਬਹੁਤ ਹੀ ਜ਼ਿਆਦਾ ਔਖੇ ਤਰੀਕੇ ਨਾਲ ਫਿਰ ਇਹ ਮੈਨੂੰ ਕਿਤਾਬ ਉੱਥੋਂ ਮਿਲੀ ਇਹ ਕਿਤਾਬ ਬਹੁਤ ਹੀ ਮਜ਼ੇਦਾਰ ਹੈ ਧੰਨਵਾਦ